ਹਾਂ ਮੈਂ ਬਹੁਤ ਮਤਲਬ ਪੰਛੀ ਦੇਖਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਦਿਨ ਦੇ ਵਿੱਚ ਸਾਡੇ ਤੋਤੇ ਆਉਂਦੇ ਹਨ ਅਤੇ ਮੋਰ ਆਉਂਦੇ ਨੇਗੇ ਅਤੇ ਕਾਂ ਵੀ ਆਉਂਦੇ ਹਨ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਪਿੰਡਾਂ ਦਾ ਮਾਹੌਲ ਹੈ ਅਤੇ ਬਾਕੀ ਮੈਂ ਰਾਤ ਨੂੰ ਦੇਖਣ ਦੀ ਵੀ ਕੋਸ਼ਿਸ਼ ਕਰਦੀ ਹਾਂ ਬਾਕੀ ਆਲ੍ਹਣੇ ਪਾਏ ਹੋਏ ਨੇਗੇ ਆਲ੍ਹਣਿਆਂ ਦੇ ਵਿੱਚ ਦਾਣੇ ਰੱਖਦੇ ਹਾਂ ਅਤੇ ਨਾਲ ਇੱਕ ਪਾਣੀ ਦਾ ਕੁੰਡਾ ਜ਼ਰੂਰ ਰੱਖਦੇ ਹਾਂ ਅਤੇ ਬਾਕੀ ਪੰਛੀ ਤਾਂ ਮੈਨੂੰ ਬਹੁਤ ਬਹੁਤ ਪਿਆਰੇ ਲੱਗਦੇ ਹਨ ਅਤੇ ਬਹੁਤ ਅੱਛੇ ਹੁੰਦੇ ਬੇ ਬਾਕੀ ਚਿੜੀਆਂ ਵੀ ਆਉਂਦੀਆਂ ਨੇਗੀਆਂ ਚਿੜੀਆਂ ਵੀ ਆਉਂਦੀਆਂ ਨੇ ਕੋਈ ਹੋਰ ਕੋਈ ਜਾਨਵਰ ਉਡਦੇ ਸ਼ਾਮ ਟਾਈਮ ਬਹੁਤ ਬਹੁਤ ਪਿਆਰੇ ਲੱਗਦੇ ਨੇ ਪਿੰਡਾਂ ਦੇ ਮਾਹੌਲ ਕਰਕੇ ਬਹੁਤ ਚੰਗੇ ਲੱਗਦੇ ਨੇਗੇ ਅਤੇ ਬਹੁਤ ਵਧੀਆ ਹੁੰਦਾ ਆ ਬਾਕੀ ਸਾਰੇ ਜਾਨਵਰਾਂ ਨੂੰ ਅਸੀਂ ਆਲ੍ਹਣੇ ਜ਼ਰੂਰ ਪਾਏ ਹੋਏ ਨੇ ਦਾਣਾ ਰੱਖਦੇ ਹਾਂ ਪਾਣੀ ਰੱਖਦੇ ਹਾਂ ਅਤੇ ਬਾਕੀ ਹੋਰ ਵੀ ਆਉਂਦੇ ਨੇਗੇ ਤਾਂ ਕਰਕੇ ਇਸ ਕਰਕੇ ਬਹੁਤ ਚੰਗੇ ਲੱਗਦੇ ਆ